ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਠੀਕ ਹੈ ਜੀ ਤੁਸੀਂ ਸੁਣਾਓ ਕਿੱਦਾਂ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਚਲੋ ਜੇ ਠੀਕ ਨਹੀਂ ਹੈ ਕੁੜੀ ਬਿਮਾਰ ਹੈ ਫਿਰ ਤਾਂ ਛੁੱਟੀ ਦੇਣੀ ਪਵੇਗੀ ਕਿੰਨੇ ਦਿਨ ਦੀ ਛੁੱਟੀ ਚਾਹੀਦੀ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਪੜ੍ਹਾਈ 'ਚ ਤਾਂ ਠੀਕ ਹੈ ਜੀ ਥੋੜ੍ਹਾ ਜਿਹਾ ਮੈਥ 'ਚ ਵੀਕ ਹੈ ਹਾਂਜੀ ਹਾਂਜੀ ਟਿਊਸ਼ਨ ਟਾਸ਼ਨ ਰੱਖ ਦਿਓ ਇਹਦੀ ਕਿਤੇ ਹਾਂਜੀ ਹਾਂਜੀ

ਇੱਦਾਂ ਨਾ ਵੀ ਬੋਰਡ ਦੀ ਕਲਾਸ ਹੁੰਦੀ ਫਿਰ ਵੀ ਨਿਆਣੇ ਨੂੰ ਫਿਰ ਔਖਾ ਹੁੰਦਾ ਹੈ ਜੇ ਟਿਊਸ਼ਨ ਰੱਖੀ ਹੋਊਗੀ ਬੱਚੇ ਨੂੰ ਫਿਰ ਥੋੜੀ ਪੜ੍ਹਾਈ ਜ਼ਿਆਦਾ ਆ ਜਾਵੇਗੀ ਹਾਂਜੀ ਹਾਂਜੀ ਉੱਦਾਂ ਤਾਂ ਉੱਦਾਂ ਤਾਂ ਠੀਕ ਹੈ ਬਾਕੀ ਸਬਜੈਕਟਾਂ 'ਚ ਠੀਕ ਹੈ ਓਕੇ ਓਕੇ ਜੀ